ਫਤਿਹਗੜ੍ਹ ਸਾਹਿਬ ਦੇ ਵਿੱਚ ਮੁੱਖ ਤੌਰ 'ਤੇ ਜਿਵੇਂ ਆਪਾਂ ਗੱਲ ਕਰਦੇ ਹਾਂ ਦਿਵਾਲੀ ਦਿਵਾਲੀ ਵਾਲੇ ਦਿਨ ਬਹੁਤ ਬੱਚਿਆਂ ਨੂੰ ਜ਼ਿਆਦਾ ਸ਼ ਖੁਸ਼ੀ ਤੇ ਹੁੰਦੀ ਹੈ ਅਤੇ ਇਸ ਦਿਨ ਇਹ ਪਟਾਕੇ ਲੈ ਕੇ ਆਉਂਦੇ ਹਾਂ ਫੁੱਲਝੱੜੀਆਂ ਲੈ ਕੇ ਆਉਂਦੇ ਆਤਸ਼ਬਾਜੀ ਲੈ ਕੇ ਆਉਂਦੇ ਖਾਸ ਕਰਕੇ ਪੰਜਾਬ ਦੇ ਵਿੱਚ ਕਰਾਲੀ ਤੋਂ ਪਟਾਕਿਆਂ ਦੀ ਥੋਕ ਮਾਰਕਿਟ ਹੁੰਦੀ ਆ ਸਾਰੇ ਉੱਥੋਂ ਦੇ ਹੀ ਲੈ ਕੇ ਆਉਂਦੇ ਹਨ ਅਤੇ ਇਸ ਦਿਨ ਕਈ ਬੰਦੇ ਨਵੇਂ ਸੂਟ ਨਵੇਂ ਸੱਭਿਆਚਾਰ ਜਿਵੇਂ ਸ਼ ਸ਼ਾਮ ਨੂੰ ਪੂਜਾ ਕਰਦੇ ਹਨ ਅਤੇ ਸ਼ਾਮ ਨੂੰ ਸ਼ਾਮ ਹੋਣ ਤੋਂ ਬਾਅਦ ਪਟਾਕੇ ਵਜਾਉਣੇ ਵਜਾਉਣ ਦਾ ਵਜਾਉਂਦੇ ਹਨ ਇਹ ਤਿਉਹਾਰ ਦੁਸਹਿਰੇ ਤੋਂ ਦਸ ਦਿਨ ਬਾਅਦ ਮਨਾਇਆ ਜਾਂਦਾ ਹੈ ਅਤੇ ਹੁਣ ਆਪਾਂ ਗੱਲ ਕਰਦੇ ਹਾਂ ਹੋਲੀ ਹੋਲੀ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਪੰਜਾਬ ਦੇ ਵਿੱਚ ਮਨਾਏ ਇਹ ਰੰਗਾਂ ਦਾ ਤਿਉਹਾਰ ਹੈ